ਮੇਰੀ ਹੁਣ ਤੱਕ ਦੀ ਸਭ ਤੋਂ ਚੁਣੌਤੀਪੂਰਨ ਹਾਈਕ ਨੈਨੀਤਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਜੋ ਕਿ ਇੱਕ ਬਹੁਤ ਹੀ ਆਪ ਦੇ ਆਪ ਦੇ ਵਿੱਚ ਐਕਸਪੀਰੀਅੰਸ ਮੇਰਾ ਬਹੁਤ ਤਕੜਾ ਰਿਹਾ ਹੈਗਾ ਜਦੋਂ ਅਸੀਂ ਉੱਥੇ ਘੁੰਮਣ ਗਏ ਉੱਥੇ ਵੱਖ ਵੱਖ ਪਹਾੜ ਝੀਲਾਂ ਵੱਖ ਵੱਖ ਪ੍ਰਕਾਰ ਦੇ ਜਾਨਵਰ ਮਲ ਮਤਲਬ ਕਿ ਇੱਕ ਵੀ ਜਿਹਨੂੰ ਆਪਾਂ ਕਹਿ ਦਈਏ ਵੀ ਬਾਇਓਡਵਰਸਿਟੀ ਦੀ ਝਲਕ ਦੇਖਣ ਨੂੰ ਮਿਲਦੀ ਹੈਗੀ ਉੱਥੋਂ ਜਦੋਂ ਅਸੀਂ ਉੱਪਰ ਗਏ ਉੱਥੇ ਉੱਦਾਂ ਦੇ ਮੋੜ ਸੜਕਾਂ ਦੇ ਠੀਕ ਆ ਐਨੇ ਡੂੰਘੇ ਅਤੇ ਐਨੇ ਖੜ੍ਹਵੀਆਂ ਚੜ੍ਹਾਈਆਂ ਮਤਲਬ ਕਿ ਦੇਖਣ ਵਾਲੀ ਹੁੰਦੀ ਉਹ ਚੀਜ਼ ਵੀ ਉੱਥੋਂ ਦੇ ਜਿਹੜੇ ਡਰਾਈਵਰ ਆ ਨਾ ਉਹਨਾਂ ਦੀ ਡਰਾਈਵਰੀ ਦੇਖਣ ਵਾਲੀ ਹੁੰਦੀ ਹੈਗੀ ਜੇ ਕਿਸੇ ਹੋਰ ਸਟੇਟ ਦਾ ਬੰਦਾ ਨਾ ਆ ਜੇ ਉਹਨੂੰ ਕਹਿ ਦੇਣਾ ਵੀ ਉੱਧਰ ਗੱਡੀ ਚਲਾਉਣੀ ਹੈਗੀ ਆ ਪਹਾੜਾਂ ਦੇ ਵਿੱਚ ਉਹ ਉੱਥੋਂ ਦੀ ਚੜ੍ਹਾਈ ਦੇਖ ਕੇ ਹੀ ਮਨ੍ਹਾ ਕਰ ਦੂਗਾ ਕਿਉਂਕਿ ਉੱਥੋਂ ਜੇ ਗੱਡੀ ਤੁਰ ਪਈ ਤਾਂ ਤੁਸੀਂ ਉਹਨੂੰ ਬ੍ਰੇਕ ਨਹੀਂ ਮਾਰ ਸਕਦੇ ਜੇ ਗੱਡੀ ਚੜ੍ਹਦੀ ਆ ਤਾਂ ਵੀ ਸੇਮ ਰੇਸ 'ਤੇ ਜਾਊਗੀ ਉੱਤਰਦੀ ਆ ਤਾਂ ਵੀ ਸੇਮ ਰੇਸ 'ਤੇ ਜਾਊਗੀ ਅਤੇ ਮੋੜ ਤਾਂ ਉੱਥੇ ਇੱਥੇ ਐਡੇ ਡੂੰਘੇ ਨੇ ਇਹੋ ਜਿਹੇ ਜੇ ਗੱਡੀ ਆਪਦੀ ਲਾਈਨ ਤੋਂ ਥੋੜ੍ਹੀ ਜਿਹੀ ਵੀ ਰਾਈਟ ਸਾਈਡ ਹੋਊਗੀ ਉਹਨੇ ਜਾ ਕੇ ਦੂਜੀ ਗੱਡੀ 'ਚ ਵੱਜਣਾ ਹੈਗਾ ਅਸੀਂ ਜਦੋਂ ਘੁੰਮਣ ਗਏ ਉੱਥੇ ਸਾਡਾ ਟੂਰ ਗਿਆ ਟ੍ਰਿਪ ਗਿਆ ਸੀਗਾ ਅਤੇ ਸਾਨੂੰ ਉੱਥੇ ਸਟੇ ਕਰਵਾਈ ਵਧੀਆ ਖਾਣਾ ਮਿਲਿਆ ਹੈ ਨਾ ਅਤੇ ਦੂਜੇ ਦਿਨ ਅਸੀਂ ਘੁੰਮਣਾ ਸ਼ੁਰੂ ਕਰਨਾ ਸੀਗਾ ਅਤੇ ਸਾਨੂੰ ਇਕ ਝੀਲ 'ਤੇ ਲਿਜਾਇਆ ਗਿਆ ਬੋਟਿੰਗ ਕਰਨ ਵਾਸਤੇ ਉੱਥੇ ਇੰਨੀ ਜ਼ਿਆਦਾ ਠੰਡ ਸੀ ਧੁੱਪ ਤਾਂ ਉੱਥੇ ਨਾ ਮਾਤਰ ਨਿਕਲਦੀ ਹੈਗੀ ਜ਼ਿਆਦਾਤਰ ਉੱਥੇ ਹਨੇਰਾ ਰਹਿੰਦਾ ਗਾ ਕਾਲੇ ਬੱਦਲ ਇਹਦੇ ਬੱਦਲਾਂ ਦੇ ਜੇ ਉਹ ਬੱਦਲ ਆਪਾਂ ਨੂੰ ਹਨੇ ਇੱਥੋਂ ਇੱਕ ਨੋਰਮਲ ਮੈਦਾਨੀ ਏਰੀਏ 'ਚ ਦੇਖਣ ਨੂੰ ਮਿਲਦੇ ਹੈਗੇ ਆ ਵਾਈਟ ਰੰਗ ਦੇ ਉਹ ਉੱਥੇ ਪੈਰਾਂ 'ਚ ਜਾਂਦੇ ਹੈਗੇ ਅਤੇ ਉੱਥੇ ਜਦੋਂ ਅਸੀਂ ਗਏ ਉੱਥੇ ਜਾ ਕੇ ਸਾਡੇ 'ਚ ਦੇ ਕੁਛ ਸਟੂਡੈਂਟ ਐਦਾਂ ਦੇ ਸੀਗੇ ਜਿਹਨਾਂ ਨੂੰ ਹਾਈਟ ਜ਼ਿਆਦਾ ਹੋਣ ਕਰਕੇ ਉੱਥੇ ਆਕਸੀਜਨ ਦੀ ਕਮੀ ਆ ਗਈ ਕੁਛ ਹੁਣ ਜਿਹੜੇ ਸਹੀ ਜਵਾਨ ਬੱਚੇ ਸੀਗੇ ਜਿਹੜੇ ਮਤਲਬ ਜਿੱਦਾਂ ਅਸੀਂ ਸੀਗੇ ਠੀਕ ਹੈ ਜਿਹੜੇ ਟਰੈਕਿੰਗ ਕਰਦੇ ਹੈਗੇ ਆ ਹਾਈਕਿੰਗ ਕਰਦੇ ਹੈਗੇ ਆ ਉਹਨਾਂ ਵਾਸਤੇ ਉਹ ਇੱਕ ਜਿਹਨੂੰ ਕਹਿ ਦਈਏ ਵੀ ਆਪਾਂ ਕੁਦਰਤ ਦਾ ਵੱਖਰਾ ਨਜ਼ਾਰਾ ਸੀਗਾ ਇਕ ਜੰਨਤ ਜੰਨਤ ਵਾਂਗੂੰ ਸੀਗਾ ਜਦੋਂ ਉੱਥੇ ਦਾ ਮਾਹੌਲ ਮੌਸਮ ਜੋ ਉੱਥੇ ਚੀਜ਼ ਦੇਖਣ ਨੂੰ ਮਿਲਦੀ ਹੈ ਨਾ ਉਹ ਕਿਤੇ ਵੀ ਨਹੀਂ ਮਿਲਦੀ ਆਸੇ ਪਾਸੇ ਉੱਧਰ ਦਾ ਜਿਹੜਾ ਖਾਣਾ ਗਾ ਉੱਧਰ ਦੇ ਲੋਕ ਨੇ ਅਤੇ ਪਹਿਰਾਵਾ ਗਾ ਹੈ ਨਾ ਉੱਥੋਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਉੱਥੇ ਐਨੇ ਐਨੇ ਜ਼ਿਆਦਾ ਮੋਸਮ ਦਾ ਫਰਕ ਆ ਉੱਥੇ ਜਿਹੜੇ ਹੋਟਲ ਨੇ ਜਿੱਥੇ ਅਸੀਂ ਰਹੇ ਸੀਗੇ ਜਿੱਥੇ ਸਾਨੂੰ ਹੋਸਟਲ ਹੋਟਲ ਸਟੇਅ ਕਰਵਾਇਆ ਗਿਆ ਸੀਗਾ ਉੱਥੇ ਹੋਟਲਾਂ ਦੇ ਪੱਖੇ ਤੱਕ ਵੀ ਹੈ ਨਹੀਂ ਮਤਲਬ ਕਿ ਉੱਥੇ ਮ ਮੱਛਰ ਤੱਕ ਤਾਂ ਬਹੁਤ ਦੂਰ ਦੀ ਗੱਲ ਹੈ ਮਤਲਬ ਪੱਖੇ ਤੱਕ ਨਹੀਂ ਲਵਾਉਂਦੇ ਕਿਉਂਕਿ ਉੱਥੇ ਮੌਸਮ ਦਾ ਬਹੁਤ ਹੀ ਜ਼ਿਆਦਾ ਫਰਕ ਆ ਬਹੁਤ ਜ਼ਿਆਦਾ ਉੱਥੇ ਟੈਂਪਰੇਚਰ ਹਮੇਸ਼ਾ ਜਿਹੜਾ ਲਾਸਟ ਟੈਂਪਰੇਚਰ ਆ ਉਹ ਉੱਥੇ ਵੀਹ ਡਿਗਰੀ ਜਾਂ ਅਠਾਰ੍ਹਾਂ ਡਿਗਰੀ ਬਸ ਇੱਥੇ ਰਹਿੰਦਾ ਹੈਗਾ